ਹੈਲੋ ਹਾਂਜੀ ਹੈਲੋ ਹਾਂਜੀ ਜੀ ਤੁਸੀਂ ਸਾਨੂੰ ਸੰਪਰਕ ਕੀਤਾ ਹੈ ਗਿੱਧੇ 'ਚ ਪਾਰਟੀਸੀਪੇਟ ਕਰਨ ਵਾਸਤੇ ਅਤੇ ਉਹਦੀ ਡਰੈੱਸ ਅਤੇ ਕੋਸਟੀਊਮ ਦੇ ਲਈ ਅਤੇ ਹਾਂਜੀ ਅਤੇ ਤੁਸੀਂ ਗਿੱਧੇ ਦੀ ਡਰੈੱਸ ਜਿਹੜੀ ਹੈ ਇੱਥੇ ਇੱਕ ਗੁਰਦਾ ਦੀਨਾਨਗਰ ਦੇ ਵਿੱਚ ਇੱਕ ਕੋਸਟਿਊਮ ਸ਼ੋ ਸ਼ੋਪ ਹੈ ਗੁਰਦਾਸਪੁਰ ਦੇ ਵਿੱਚ ਮੀਨਾਥ ਗਾਰਮੈਂਟ ਕਰਕੇ ਤੁਸੀਂ ਉੱਥੇ ਜਾਣਾ ਹੈ ਅਤੇ ਉਹਨਾਂ ਨੂੰ ਸਪੈਸ਼ਲ ਜਾ ਕੇ ਕਹਿਣਾ ਹੈ ਕਿ ਮੈਂ ਇਸ ਤਰ੍ਹਾਂ ਇੱਕ ਪ੍ਰੋਗਰਾਮ 'ਚ ਪਾਰਟੀਸੀਪੇਟ ਕੀਤਾ ਹੈ ਅਤੇ ਉੱਥੋਂ ਤੁਸੀਂ ਇੱਕ ਲਹਿੰਗਾ ਉਹਦੇ ਨਾਲ ਕੁੜਤੀ ਪਲੱਸ ਉਹਦੇ ਨਾਲ ਜਿਹੜਾ ਜੂਅਲਰੀ ਹੋਏਗੀ ਉਹਦੇ ਵਿੱਚ ਤੁਸੀਂ ਕੈਂਠਾ ਲੈਣਾ ਹੈਗਾ ਹੈ ਅਤੇ ਪਿੱਪਲ ਪੱਤੀਆਂ ਵਾਲੇ ਕਾਂਟੇ ਲੈਣੇ ਹੈਗੇ ਨੇ ਔਰ ਉੱਪਰ ਅ ਮੱਥੇ 'ਤੇ ਜਿਹੜਾ ਟਿੱਕਾ ਹੋਏਗਾ ਉਹ ਵੀ ਦੂਸਰਾ ਵਾਲਾ ਲੈਣਾ ਹੈ ਅਤੇ ਜਿਹੜਾ ਲਹਿੰਗਾ ਹੋਏਗਾ ਉਹ ਤੁਸੀਂ ਮੇਕ ਸ਼ੋਅਰ ਕਿ ਉਹਦੇ ਉੱਪਰ ਪ੍ਰੋਪਰਲੀ ਗੋਟਾ ਵਗੈਰਾ ਲੱਗਾ ਹੋਏ ਕੁੜਤੀ ਉਹਦੀ ਥੋੜੀ ਲੋਂਗ ਹੋਏ ਤਾਂ ਕਿ ਤੁਸੀਂ ਪਾਰਟੀਸੀਪੇਟ ਕਰੋ ਤੁਹਾਡੀ ਡਰੈੱਸ ਤੋਂ ਹੀ ਨਜ਼ਰ ਆਏ ਤੁਸੀਂ ਪੂਰਾ ਇੱਕ ਗਿੱਧੇ ਦੀ ਮਤਲਬ ਮੁਟਿਆਰ ਲੱਗੋਂ ਦੂਰੋਂ ਦੇਖਣ ਤੋਂ ਹੀ ਠੀਕ ਹੈ ਹੋਰ ਤੁਹਾਨੂੰ ਇਹਦੇ ਵਿੱਚ ਕੋਈ ਡਰੈੱਸ ਦੇ ਰਿਗਾਰਡਿੰਗ ਜਾਂ ਕੋਈ ਹੋਰ ਡਾਊਟ ਹੈ ਤਾਂ ਮੈਨੂੰ ਦੱਸੋ

ਮਟੀਰੀਅਲ ਦੀ ਕੁਆਲਟੀ ਤੁਹਾਨੂੰ ਅੱਛੀ ਮਿਲੇਗੀ ਅਤੇ ਉਹਨੂੰ ਤੁਸੀਂ ਵੀਅਰ ਕਿਸ ਤਰ੍ਹਾਂ ਕਰਨਾ ਹੈ ਉਹ ਬਸ ਅੱਛਾ ਤਰੀਕਾ ਹੋਣਾ ਚਾਹੀਦਾ ਹੈ ਬਾਕੀ ਉਹ ਮਤ ਤੁਸੀਂ ਬਸ ਉਸ ਡਰੈੱਸ ਨੂੰ ਚੰਗੀ ਤਰ੍ਹਾਂ ਕੈਰੀ ਕਰਨਾ ਹੈਗਾ ਬਾਕੀ ਉਹ ਲੁੱਕ ਆਪਣੀ ਖੁਦ ਦੀ ਡਰੈੱਸ ਹੀ ਦਏਗੀ ਦੁਪੱਟਾ ਜਿਹੜਾ ਵਾ ਉਹਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਸ਼ੋਅ ਅੱਪ ਕਰਨਾ ਹੈ ਦੋ ਦੁਪੱਟੇ ਲੈਣੇ ਹੈ ਇੱਕ ਦੁਪੱਟਾ ਤੁਸੀਂ ਮੋਢੇ ਵਾਸਤੇ ਲਓਗੇ ਇੱਕ ਦੁਪੱਟਾ ਤੁਸੀਂ ਸਿਰ ਵਾਸਤੇ ਲਓਗੇ ਸਿਰ ਕੱਜਿਆ ਹੋਣਾ ਚਾਈਦਾ ਹੈ ਜੋ ਕਿ ਗਿੱਧੇ ਦੇ ਦੌਰਾਨ ਬਹੁਤ ਅੱਛਾ ਲੱਗਦਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ